ਹਾਂ ਬਿਲਕੁਲ ਮੈਂ ਸ਼ੁਰੂ ਤੋਂ ਹੀ ਸਕੂਲ ਟਾਈਮ ਤੋਂ ਹੀ ਚਿੱਤਰਕਾਰੀ ਵਿੱਚ ਬਹੁਤ ਇੰਟਰਸਟ ਰੱਖਦੀ ਸੀ ਮੈਂ ਸਿੱਖੀ ਹੈ ਸਕੂਲ ਵਿੱਚ ਸਕੂਲ ਟਾਈਮ ਤੋਂ ਸਾਡੇ ਪਰੋਪਰ ਆਰਟ ਲੈਕ ਲੈਕਚਰ ਲੱਗਦੇ ਹੁੰਦੇ ਸੀ ਅਸੀਂ ਪਰੋਪਰ ਲੈਕਚਰ ਅਟੈਂਡ ਕਰਦੇ ਹੁੰਦੇ ਸੀ ਮੈਨੂੰ ਸ਼ੁਰੂ ਤੋਂ ਹੀ ਬਹੁਤ ਹੀ ਜ਼ਿਆਦਾ ਰੁਝਾਨ ਸੀਗਾ ਚਿੱਤਰਕਾਰੀ ਵਿੱਚ ਮੈਂ ਸ਼ੁਰੂ ਤੋਂ ਹੀ ਬਹੁਤ ਡਰਾਇੰਗਸ ਬਣਾਉਂਦੀ ਹੁੰਦੀ ਸੀ ਜਦੋਂ ਵੀ ਮੈਨੂੰ ਫ੍ਰੀ ਟਾਈਮ ਮਿਲਦਾ ਆ ਮੈਂ ਕੋਪੀ ਪੈੱਨ ਪੇਪਰ ਲੈ ਕੇ ਅਪਣੀ ਇਮੈਜਨੀਰੀ ਪਿਚਰ ਕੁਛ ਵੀ ਜਾਂ ਜੋ ਮੇਰੇ ਸਾਹਮਣੇ ਪਿਆ ਹੁੰਦਾ ਹੈ ਮੈਂ ਉਸ ਨੂੰ ਹੀ ਦੇਖ ਕੇ ਬਹੁਤ ਕੁਛ ਬਹੁਤ ਅੱਛਾ ਜੋ ਵੀ ਮੇ ਜੋ ਵੀ ਚਿੱਤਰਕਾਰੀ ਮੈਨੂੰ ਪਸੰਦ ਆਉਂਦੀ ਆ ਮੈਂ ਉਸਨੂੰ ਡਰੋਅ ਕਰ ਲੈਂਦੀ ਹਾਂ ਮੇਰੇ ਘਰ ਵਿੱਚ ਬਹੁਤ ਹੀ ਜ਼ਿਆਦਾ ਡਰੋਇੰਗਸ ਲੱਗੀਆਂ ਹੋਈਆਂ ਨੇ ਮੇੇਰੇ ਖੁਦ ਦੇ ਹੱਥ ਦੇ ਬਣਾਏ ਹੋਏ ਚਿੱਤਰ ਘਰ ਵਿੱਚ ਲਗਾਏ ਹੋਏ ਨੇ ਮੈਂ ਬਹੁ ਆਪਣੇ ਫਰੈਂਡਸ ਨੂੰ ਖੁਦ ਦੇ ਬਣਾਏ ਹੋਏ ਬਹੁਤ ਅੱਛੇ ਅੱਛੇ ਚਿੱਤਰ ਵੀ ਗਿਫਟ ਕੀਤੇ ਹੋਏ ਨੇ ਜੋ ਕਿ ਸਭ ਨੂੰ ਬਹੁਤ ਪਸੰਦ ਆਉਂਦੇ ਨੇ ਅੰਮ੍ਰਿਤਸਰ ਵਿੱਚ ਵੀ ਬ ਬਹੁਤ ਹੀ ਕੋਲਜ ਕੋਰਸ ਅਵੇਲੇਵਲ ਹਨ ਜਿਵੇਂ ਕਿ ਫਾਈਨ ਆਰਟਸ ਇੰਨੂਵੇਟਿਵ ਗੈਲਰੀ ਆਰਟ ਗੈਲਰੀ ਬਹੁਤ ਹੀ ਅੱਛੀ ਜਗ੍ਹਾ ਕੋਲਜ ਕੋਰਸ ਹਨ ਜਿੱਥੇ ਕਿ ਆਪਾਂ ਕਲਾਕਾਰਾਂ ਨੂੰ ਜੋ ਕਿ ਮਦਦ ਕਰਦੇ ਨੇ ਇਹ ਸਿੱਖਣ ਲਈ ਮੈਂ ਆਪਣੀ ਬੈਚਲਰਸ ਇਨ ਫਾਈਨ ਆਰਟਸ ਕਰ ਰਹੀ ਹਾਂ ਤਾਂ ਕਿ ਤਾਂ ਜੋ ਮੈਂ ਇਸ ਵਿੱਚ ਹੋਰ ਅੱਛੀ ਮੁਹਾਰਤ ਪ੍ਰਾਪਤ ਕਰ ਸਕਾਂ ਅਤੇ ਇਹਨੂੰ ਵੱਡੇ ਪੱਧਰ 'ਤੇ ਲੈ ਕੇ ਜਾ ਸਕਾਂ ਮੈਂ ਚਾਹੁੰਦੀ ਹਾਂ ਕਿ ਮੈਂ ਪੀ ਐੱਚ ਡੀ ਕਰਕੇ ਇਸ ਅਪਣੀ ਇਸ ਸਕਿੱਲ ਨੂੰ ਹੋਰ ਇੰਮਪਰੂਵ ਕਰਕੇ ਕਿਸੇ ਕੋਲਜ ਜਾਂ ਸਕੂਲ ਵਿੱਚ ਆਪਣੀ ਡਿਗਰੀ ਪ੍ਰਾਪਤ ਕਰਕੇ ਪੜ੍ਹਾਉਣ ਜਾਂ ਟੀਚਿੰਗ ਕਰਨ ਲ ਲੱਗ ਜਾਵਾਂ ਮੈਂ ਇਸ ਇੱਕ ਆਪਣੀ ਕਲਾ ਤਾਂ ਕਿ ਬੱਚਿਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਸਿਖਾ ਸਕਾਂ ਉਨ੍ਹਾਂ ਦੇ ਵੀ ਸੁਪਨੇ ਪੂਰੇ ਕਰ ਸਕਾਂ ਉ ਉਨ੍ਹਾਂ ਨੂੰ ਵੀ ਅ ਕਰੀਏਚਰ ਆਰਟ ਸਿਖਾ ਸਕਾਂ ਤਾਂ ਜੋ ਉਨ੍ਹਾਂ ਨੂੰ ਮੈਂ ਨਾਲ ਦੇ ਨਾਲ ਹੀ ਅਪਣਾ ਇੱਕ ਪਲੋਟ ਵੀ ਦੇਖ ਰਹੀ ਹਾਂ ਕਿ ਤਾਂ ਜੋ ਮੈਂ ਆਪਣੀ ਖੁਦ ਦੀ ਆਰਟ ਗੈਲਰੀ ਖੋਲ ਸਕਾਂ ਜਾਂ ਇੱਕ ਆਰਟ ਅਕੈਡਮੀ ਖੋਲ ਸਕਾਂ ਮੇਰਾ ਸੁਪਨਾ ਹੈ ਕਿ ਮੈਂ ਆਪਣੀ ਡਿਗਰੀ ਪ੍ਰਾਪਤ ਕਰਕੇ ਕੋਈ ਅੱਛੀ ਜੋਬ ਕਰਨ ਲੱਗ ਪਵਾਂ ਇਸ ਚਿੱਤਰਕਾਰੀ ਦੇ ਹੀ ਪ੍ਰਫੈਸ਼ਨ ਵਿੱਚ ਜਾਂ ਫਿਰ ਮੈਂ ਆਪਣੇ ਨਾਲ ਨਾਲ ਇੱਕ ਆਰਟ ਗੈਲਰੀ ਜਾਂ ਇੱਕ ਆਰਟ ਅਕੈਡਮੀ ਖੋਲ ਸਕਾਂ